ਹਾਂਜੀ ਮੇਰਾ ਨਾਮ ਰੀਤੂ ਹੈ ਮੈਂ ਕੁਕਿੰਗ ਕਾਫੀ ਅੱਛੀ ਕਰ ਲੈਂਦੀ ਮੈਨੂੰ ਕੁਕਿੰਗ ਦਾ ਬਹੁਤ ਸ਼ੌਕ ਹੈ ਮੈਂ ਮਤਲਬ ਕਿ ਹਰ ਤਰ੍ਹਾਂ ਦੇ ਸੋਸ ਵੀ ਬਣਾ ਲੈਂਦੀ ਹਾਂ ਖਾਣਾ ਵਗੈਰਾ ਮਤਲਵ ਕਿ ਜਿਸ ਤਰ੍ਹਾਂ ਮੈਂ ਡੋਸਾ ਡੋਕਲਾ ਇਡਲੀ ਵਗੈਰਾ ਬਣਾ ਲੈਂਦੀ ਹਾਂ ਕਾਫੀ ਜਿਸ ਤਰ੍ਹਾਂ ਕੇਕ ਦਾ ਵੀ ਮੈਨੂੰ ਸ਼ੌਕ ਅੱਜ ਕੱਲ੍ਹ ਕੇਕ ਦਾ ਵੀ ਕਰ ਰਹੀ ਹਾਂ ਬਾਕੀ ਜਿੱਥੇ ਤੱਕ ਵਿਦੇਸ਼ੀ ਖਾਣੇ ਦੀ ਗੱਲ ਕਰੀਏ ਵਿਦੇਸ਼ੀ ਮਸਾਲੇ ਦੀ ਗੱਲ ਕਰੀਏ ਇਹਦੇ ਵਿੱਚ ਇਸ ਤਰ੍ਹਾਂ ਅਜੀਨੋਮੋਟੋ ਹੈ ਇਹ ਸਾਡੇ ਉਹਦੇ 'ਚ ਪੈ ਜਾਂਦਾ ਨੂਡਲਸ 'ਚ ਪੈ ਜਾਂਦਾ ਇਹਦੇ ਨਾਲ ਕਾਫੀ ਅੱਛਾ ਟੇਸਟ ਹੋ ਜਾਂਦਾ ਮਿਕਸ ਵੈੱਜ ਵਿੱਚ ਮਿਕਸ ਵੈੱਜ ਅਜੀਨੋਮੋਟੋ ਤੋਂ ਵਗੈਰ ਤਿਆਰ ਹੀ ਨਹੀਂ ਹੁੰਦੀ ਮਿਕਸ ਵੈੱਜ ਹੋ ਗਈ ਔਰ ਅ ਚੀਜ਼ ਚਿੱਲੀ ਹੋ ਗਿਆ ਬਾਕੀ ਆਪਣੇ ਸੋ ਪਾਸਤੇ ਵਗੈਰਾ ਵਿੱਚ ਵੀ ਵਾਈਟ ਸੋਸ ਵਗੈਰਾ ਯੂਜ ਹੁੰਦੀ ਹੈ ਵਿਦੇਸ਼ੀਆਂ ਵਿੱਚ ਇਸ ਤਰ੍ਹਾਂ ਕਈ ਹੁੰਦੇ ਜਿਹੜੇ ਵਿਦੇਸ਼ੀ ਵਿੱਚ ਸਾਡੇ ਯੂਜ ਹੁੰਦੇ ਆ ਅਜੀਨੋਮੋਟੋ ਤਾਂ ਕਾਫੀ ਕਾਫੀ ਚੀਜ਼ਾਂ 'ਚ ਵਰਤੀ ਜਾਂਦੀ ਇਹਦੇ ਨਾਲ ਬਹੁਤ ਅੱਛਾ ਟੇਸਟ ਬਣ ਜਾਂਦਾ ਹੈ